ਹੈਲੋ ਹਾਂਜੀ ਹਾਂਜੀ ਕੋਮਲਪ੍ਰੀਤ ਹੀ ਹਾਂ ਹਾਂਜੀ ਬਹੁਤ ਸਾਰੇ ਪੰਜਾਬੀ ਐਕਟਰ ਆ ਜਿਹੜੇ ਬੋਲੀਵੁੱਡ 'ਚ ਕੰਮ ਕਰਦੇ ਆ ਜਿਵੇਂ ਦਲਜੀਤ ਦੋਸਾਂਝ ਆ ਉਹਨਾਂ ਨੇ ਹੁਣੇ ਹੁਣੇ ਹੀ ਕੰਮ ਕੀਤਾ ਬੋਲੀਵੁੱਡ 'ਚ ਬੜੇ ਫੇਮਸ ਹੋਏ ਹੁਣੇ ਅਤੇ ਜਿਵੇਂ ਗਿੱਪੀ ਗਰੇਵਾਲ ਆ ਉਹਨਾਂ ਨੇ ਵੀ ਪਹਿਲਾਂ ਕੰਮ ਕੀਤਾ ਸੀ ਬੋਲੀਵੁੱਡ 'ਚ ਉਹ ਵੀ ਬਹੁਤ ਫੇਮਸ ਆ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਬੋਲੀਵੁੱਡ ਫਿਲਮਾਂ 'ਚ ਅਤੇ ਪਹਿਲੇ ਜਿਹੜੇ ਆਪਣੇ ਐਕਟਰ ਸੀ ਧਰਮਿੰਦਰ ਹੋਏ ਸਨੀ ਦਿਓਲ ਸਾਰਿਆਂ ਨੇ ਇਹ ਸਾਰੇ ਪੰਜਾਬੀ ਹੀ ਉਹਨਾਂ ਨੇ ਬੋਲੀਵੁੱਡ ਵਿੱਚ ਆਪਣਾ ਬਹੁਤ ਵਧੀਆ ਕੰਮ ਕੀਤਾ ਸੀ ਅਤੇ ਐਕਟਰਸ 'ਚ ਸੋਨਮ ਬਾਜਵਾ ਸੀ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਫਿਲਮਾਂ 'ਚ ਅਤੇ ਬੜੇ ਫੇਮਸ ਹੋਏ ਬੋਲੀਵੁੱਡ ਫਿਲਮਾਂ 'ਚ ਵੀ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਅਤੇ ਜੇ ਗੱਲ ਕੀਤੀ ਜਾਵੇ ਸਿੰਗਰਾਂ ਦੀ ਸੁਖਵਿੰਦਰ ਸਿੰਘ ਸੀ ਜਿਹੜੇ ਪੰਜਾਬੀ ਫੇਮਸ ਸਿੰਗਰ ਸੀ ਉਹਨਾਂ ਨੇ ਬੋਲੀਵੁੱਡ ਵਿੱਚ ਹਿੰਦੀ ਸੌਂਗ ਗਾਏ ਸੀ ਉਹ ਵੀ ਬਹੁਤ ਫੇਮਸ ਹੋਏ ਹਾਂਜੀ ਅਤੇ ਇੱਕ ਸੋਨੂੰ ਸੂਦ ਸੀ ਉਹਨਾਂ ਨੇ ਉਹ ਰਾਈਟਰ ਸੀ ਉਹ ਵੀ ਬਹੁਤ ਫੇਮਸ ਸੀ ਬੋਲੀਵੁੱਡ ਵਿੱਚ ਉਹਨਾਂ ਨੇ ਸੌਂਗ ਰਾਈਟ ਕੀਤੇ ਬਹੁਤ ਵਧੀਆ ਉਹਨਾਂ ਦਾ ਵੀ ਕੰਮ ਰਿਹਾ ਅਤੇ ਸ਼ਿ ਜਿੰਮੀ ਸ਼ੇਰਗਿੱਲ ਸੀ ਉਹਨਾਂ ਦੀ ਵੀ ਬਹੁਤ ਵਧੀਆ ਐਕਟਿੰਗ ਸੀ ਬਹੁਤ ਵਧੀਆ ਐਕਟਰ ਸੀਗੇ ਉਹ ਵੀ ਬੋਲੀਵੁੱਡ ਵਿੱਚ ਪੰਜਾਬੀ ਸੀ ਉਹ ਵੀ ਵੈਸੇ ਹਾਂਜੀ ਇਹ ਸਾਰੇ ਐਕਟਰ ਸੀ ਜਿਨ੍ਹਾਂ ਨੇ ਬੋਲੀਵੁੱਡ ਦੇ ਵਿੱਚ ਵੀ ਆਪਣਾ ਰਾ ਨਾਮ ਰੋਸ਼ਨ ਕੀਤਾ ਸਾਰੇ ਪੰਜਾਬੀ ਸੀ ਹਾਂਜੀ ਓਕੇ ਜੀ ਥੈਂਕ ਯੂ